ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਮਤਲਬ ਵੀ ਘਰ ਰੈਨੋਵੇਟ ਕਰਵਾਉਣਾ ਕਿ ਜੀ ਕੋਈ ਰੂਮ ਕੋਈ ਸਿੰਗਲ ਰੂਮ ਰੈਨੋਵੇਟ ਕਰਵਾਉਣਾ ਤੁਸੀਂ ਐਂ ਦੱਸੋ ਪਹਿਲਾਂ ਮੇਰੀ ਗੱਲ ਸੁਣੋ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਵੀ ਕਿਹੜੇ ਹਿੱਸੇ 'ਤੇ ਜ਼ਿਆਦਾ ਦਿੱਕਤ ਆਉਂਦੀ ਹੈ ਘਰਦੇ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਡਿਜ਼ਾਇਨ ਹੁੰਦੇ ਜਿਹੜੇ ਜੀ ਉਹ ਤੁਹਾਨੂੰ ਮੈਂ ਦਿਖਾ ਦਊਂਗਾ ਉਹਨਾਂ 'ਚੋਂ ਤੁਸੀਂ ਵੇਖ ਲਓ ਜੇ ਜੋ ਤੁਹਾਨੂੰ ਬੈਸਟ ਲੱਗਾ ਆਪਾਂ ਉਹ ਤੁਹਾਡੀ ਰਸੋਈ ਦੇ ਏਰੀਏ ਦੇ ਹਿਸਾਬ ਨਾਲ ਆਪਾਂ ਵੇਖ ਲਾਂਗੇ ਵੀ ਕੀ ਸਭ ਤੋਂ ਜ਼ਿਆਦਾ ਚੀਜ਼ ਬੈਸਟ ਹੋ ਸਕਦੀ ਵੀ ਉਹ ਤੁਹਾਨੂੰ ਦਿੱਕਤ ਘੱਟ ਤੋਂ ਘੱਟ ਆਉਣ ਵੀ ਚੀਜ਼ ਰੱਖਣ ਨੂੰ ਜਾਂ ਚੱਕਣ ਨੂੰ ਜਾਂ ਜਿੱਦਾਂ ਦੀ ਵੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਤੁਸੀਂ ਮੈਂ ਇੱਦਾਂ ਕਰੂੰਗਾ ਅੱਜ ਮੈਂ ਤੁਹਾਡੇ ਕੋਲ ਵਿਜਿਟ ਕਰ ਲੂੰਗਾ ਘਰ ਤੁਹਾਡੇ ਨਾਲ ਮੈਂ ਤੁਹਾਡੀ ਰਸੋਈ ਦਾ ਏਰੀਆ ਦੇਖ ਲੂੰਗਾ ਵੀ ਕਿੰਨਾ ਕੁ ਹੈਗਾ ਵਾ ਜੋ ਜੋ ਚੀਜ਼ਾਂ ਖਰਾਬ ਹੋ ਚੁੱਕੀਆਂ ਹੋਈਆਂ ਉਹ ਨਾਲੇ ਵੇਖ ਲੂੰਗਾ ਜੀ ਫਿਰ ਮੈਂ ਤੁਹਾਨੂੰ ਸਾਰਾ ਜੋ ਵੀ ਹੋਵੇਗਾ ਐਸਟੀਮੇਟ ਦੇ ਦੂੰਗਾ ਹਰ ਇੱਕ ਚੀਜ਼ ਦਾ ਓਕੇ ਓਕੇ ਓਕੇ ਰੂਮ ਤੁਸੀਂ ਬੈਡਰੂਮ ਰੈਨੋਵੇਟ ਕਰਵਾਉਣਾ ਹੈ ਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਆਪਣੇ ਕੋਲ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਣੇ ਕੋਲ ਆਪਸ਼ਨਸ ਹੈਗੀਆਂ ਵਾ ਜੋ ਤੁਹਾਨੂੰ ਸਟਾਈਲ ਆਪਣੇ ਕੋਲ ਬਹੁਤ ਹੈਗੇ ਰੂਮ ਦੇ ਡਿਫਰੈਂਟ ਡਿਫਰੈਂਟ ਅਤੇ ਜੋ ਤੁਹਾਨੂੰ ਸਹੀ ਲੱਗੇਗਾ ਚੰਗਾ ਲੱਗੇਗਾ ਉਹ ਆਪਾਂ ਤੁਹਾਡੇ ਰੂਮ ਅਤੇ ਰੈਨੋਵੇਟ ਕਰ ਦਾਂਗੇ ਓਕੇ ਵਾਲਪੇਪਰ ਸਰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਲਵਾਇਆ ਨੂੰ ਤੁਹਾਨੂੰ ਓਕੇ ਓਕੇ ਓਕੇ ਠੀਕ ਹੈ ਓਕੇ ਨਹੀਂ ਹੁਣ ਤੁਸੀਂ ਫਿਰ ਜਦੋਂ ਆਪਾਂ ਹੁਣ ਤੁਹਾਡਾ ਰੂਮ ਰੈਨੋਵੇਟ ਕਰਨਾ ਤੁਸੀਂ ਕੀ ਚਾਹੁੰਦੇ ਹੋ ਵੀ ਵਾਲਪੇਪਰ ਕਰੀਏ ਕਿ ਜਾਂ ਕੋਈ ਆਪਾਂ ਪੀ ਵੀ ਸੀ ਵਗੈਰਾ ਸ਼ੀਟ ਹੁੰਦੀਆਂ ਨੇ ਵੀ ਉੱਦਾਂ ਦਾ ਕੁਛ ਤੁਹਾਡਾ ਟੇਸਟ ਕੀ ਆਪਾਂ ਫਿਰ ਉਸ ਤਰੀਕੇ ਨਾਲ ਰੈਨੋਵੇਟ ਕਰਾਂਗੇ ਓਕੇ ਓਕੇ ਠੀਕ ਹੈ ਜੀ ਹਾਂਜੀ ਬੈਸਟ ਬੈਸਟ ਆਪਸ਼ਨ ਬਿਲਕੁਲ ਜੀ ਹਾਂਜੀ ਮੈਂ ਤੁਹਾਨੂੰ ਅੱਜ ਭੇਜ ਦਿੰਦਾ ਵੈਸੇ ਤਾਂ ਸ਼ਾਮ ਤੱਕ ਮੈਂ ਤੁਹਾਡੇ ਹਿੱਸੇ ਵਿਜਿਟ ਕਰ ਦੂੰਗਾ ਜੀ ਠੀਕ ਹੈ ਜੀ